ਸਿਰ ਦਰਦ ਦੇ ਇਲਾਜ ਲਈ ਵੈਸੇ ਤਾਂ ਹੁਣ ਅੱਜ ਕੱਲ੍ਹ ਤਾਂ ਐਲੋਪੈਥੀ ਦੀਆਂ ਦਵਾਈਆਂ ਹੀ ਲੋਕ ਵੱਧ ਖਾਈ ਜਾਂਦੇ ਨੇ ਡ੍ਰਿਸਪ੍ਰਿਨ ਲੈ ਲਉ ਇਹ ਕਰ ਲਉ ਇਹ ਕਰ ਲਉ ਪਰ ਕੁਝ ਦੇਸੀ ਨੁਸਖੇ ਵੀ ਹੈਗੇ ਨੇ ਜਿਹੜੇ ਕਿ ਜਿਵੇਂ ਕਿ ਸਾਡੇ ਇੱਕ ਤਾਂ ਕਹਿੰਦੇ ਨੇ ਨਿੰਬੂ ਦਾ ਪੱਤਾ ਖਾ ਲਉ ਨਿੰਬੂ ਦਾ ਪੱਤਾ ਚੱਬ ਲਉ ਕਹਿੰਦੇ ਸਿਰ ਦਰਦ ਠੀਕ ਹੋ ਜਾਂਦਾ ਅਤੇ ਨਿੰਬੂ ਦੇ ਪੱਤੇ ਤੋਂ ਇਲਾਵਾ ਇੱਕ ਲੰਬੇ ਲੰਬੇ ਸਾਹ ਖਿੱਚਣ ਦੇ ਨਾਲ ਵੀ ਮਤਲਬ ਤੁਸੀਂ ਕਿਸੇ ਨਾਲ ਗੱਲ ਬਾਤ ਨਾ ਕਰੋ ਇਕਾਂਤ ਹੋ ਕੇ ਇੱਕਲੇ ਹੋ ਕੇ ਬਹਿ ਜੋ ਅਤੇ ਤਾਜ਼ੀ ਹਵਾ ਦੇ ਵਿੱਚ ਲੰਬੇ ਲੰਬੇ ਸਾਹ ਹੌਲੀ ਹੌਲੀ ਹੈ ਨਾ ਲਉ ਤਾਂ ਤਾਂ ਵੀ ਕਹਿੰਦੇ ਸਿਰ ਦਰਦ ਜਿਹੜਾ ਹੈਗਾ ਹਟ ਜਾਂਦਾ ਨਹੀਂ ਫਿਰ ਉਸ ਤੋਂ ਬਾਅਦ ਆਰਾਮ ਕਰਨ ਨੂੰ ਕਿਹਾ ਜਾਂਦਾ ਹੈ ਕਿ ਹੈ ਨਾ ਸੌਂ ਜੋ ਨੀਂਦ ਪੂਰੀ ਕਰ ਲਉ ਕਈ ਵਾਰ ਉਹਦੇ ਕਰਕੇ ਫਿਰ ਦਰਦ ਹੋ ਸਕਦਾ ਸੋ ਜਦੋਂ ਬੰਦਾ ਸੌਂ ਲੈਂਦਾ ਹੈ ਨੀਂਦ ਵਗੈਰਾ ਪੂਰੀ ਕਰ ਲੈਂਦਾ ਤਾਂ ਵੀ ਉਹਨੂੰ ਕੰਮਕਾਰ ਤੋਂ ਛੁਡਵਾ ਕੇ ਵੀ ਤੂੰ ਬਹਿ ਜਾ ਆਰਾਮ ਕਰ ਤੇਰਾ ਸਿਰ ਦਰਦ ਠੀਕ ਹੋ ਜੂਗਾ ਇਹ ਕੁਝ ਤਰੀਕੇ ਨੇ ਜਿਹੜੇ ਘਰੇਲੂ ਨੇ ਠੀਕ ਹੈ ਵੈਸੇ ਨਹੀਂ ਤਾਂ ਜੀ ਆਪਣਾ ਦਵਾਈਆਂ ਹੈਗੀਆਂ ਹੀ ਨੇ ਉਹ ਦਵਾਈਆਂ ਦੇ ਨਾਲ ਲੋਕ ਚੱਲੀ ਜਾਂਦੇ ਨੇ ਜੋ ਚੱਕ ਲਈ ਅੱਜ ਕੱਲ੍ਹ ਤਾਂ ਵੈਸੇ ਦੇਸੀ ਨੁਸਖੇ ਜਿਹੜੇ ਹੈਗੇ ਨੇ ਸ਼ੋਸ਼ਲ ਮੀਡੀਆ ਕਰਕੇ ਦੁਬਾਰਾ ਕੁਛ ਲੋਕ ਵਰਤਣ ਤਾਂ ਲੱਗ ਗਏ ਪਰ ਪਹਿਲਾਂ ਵਰਤਦੇ ਸੀ ਜ਼ਿਆਦਾ ਹੁਣ ਤਾਂ ਬਸ ਦਵਾਈ ਲੈ ਲਈ ਕੰਮ ਚੱਲ ਗਿਆ